ਸਤਿ ਸ਼੍ਰੀ ਅਕਾਲ ਮੇਰਾ ਨਾਮ ਜਸਮੀਨ ਕੌਰ ਹੈ ਅਤੇ ਮੈਨੂੰ ਔਨਲਾਈਨ ਸ਼ੋਪਿੰਗ ਦਾ ਬਹੁਤ ਸ਼ੌਕ ਹੈ ਜਾਂ ਤੁਸੀਂ ਕਹਿ ਸਕਦੇ ਹੋ ਕਿ ਮੈਨੂੰ ਬਜ਼ਾਰ ਜਾਣ ਦਾ ਟਾਇਮ ਨਹੀਂ ਸੀ ਲੱਗਦਾ ਤਾਂ ਕਰਕੇ ਮੈਂ ਔਨਲਾਈਨ ਸ਼ੋਪਿੰਗ ਕਰਦੀ ਹਾਂ ਮੈਂ ਆਪਣੇ ਫੋਨ ਵਿੱਚ ਬਹੁਤ ਤਰੀਕੇ ਦੇ ਐਪ ਫਲਿਪਕਾਰਟ ਐਮਾਜ਼ੋਨ ਅਤੇ ਆਦਿ ਬਹੁਤ ਐਪ ਡਾਊਨਲੋਡ ਕੀਤੇ ਹਨ ਇੱਕ ਦਿਨ ਮੈਂ ਫਲਿਪਕਾਰਟ ਖੋਲ੍ਹਿਆਂ ਤਾਂ ਉੱਥੇ ਏਅਰਪੋਰਟਸ ਅਤੇ ਏਅਰਬਡਸ ਦੀ ਐਡ ਚੱਲ ਰਹੀ ਸੀ ਤਾਂ ਮੈਂ ਸੋਚਿਆ ਕਿ ਚਲੋ ਮੈਂ ਵੀ ਔਡਰ ਕਰ ਕੇ ਵੇਖਦੀ ਹਾਂ ਅਤੇ ਮੈਂ ਉਹਨਾਂ ਨੂੰ ਪੇਮੈਂਟ ਕੀਤੀ ਅਤੇ ਉਨ੍ਹਾਂ ਨੇ ਮੈਨੂੰ ਰਿਪਲਾਏ ਕੀਤਾ ਕਿ ਜਿਹੜਾ ਤੁਹਾਡਾ ਔਡਰ ਹੈ ਉਹ ਤੁਹਾਨੂੰ ਦੋ ਦਿਨ ਵਿੱਚ ਮਿਲ ਜਾਵੇਗਾ ਬਟ ਗਲ਼ਤ ਗੱਲ ਇਹ ਰਹੀ ਕਿ ਉਹ ਦੋ ਦਿਨ ਦੀ ਬਜਾਇ ਮੈਨੂੰ ਪੰਜਵੇਂ ਦਿਨ ਮਿਲਿਆ ਚਲੋ ਖੈਰ ਇਹ ਤਾਂ ਕੋਈ ਨਹੀਂ ਉਹ ਤਾਂ ਮੈਂ ਸਾਰ ਲੈਂਦੀ ਪਰ ਜਦੋਂ ਮੈਂ ਉਹ ਪਾਰਸਲ ਓਪਨ ਕਰਕੇ ਦੇਖਿਆ ਤਾਂ ਉਹਦੇ ਵਿੱਚ ਜਿਹੜੇ ਏਅਰਪੋਰਟਸ ਸੀ ਉਹਨਾਂ ਦਾ ਕਲਰ ਹੀ ਚੇਂਜ਼ ਸੀ ਅਤੇ ਦੂਜੀ ਗੱਲ ਜਿਹੜੀ ਇਹ ਸੀ ਕਿ ਉਹਨਾਂ ਦਾ ਦਾ ਚੇਂਜ਼ ਸੀ ਬਟ ਜਦੋਂ ਮੈਂ ਉਨ੍ਹਾਂ ਨੂੰ ਕੰਨਾਂ 'ਚ ਲਗਾ ਕੇ ਦੇਖਿਆ ਤਾਂ ਉਹ ਤਾਂ ਅਟੈਚ ਹੀ ਨਹੀਂ ਹੋ ਰਹੇ ਸਨ ਤਾਂ ਬਾਅਦ 'ਚ ਪਤਾ ਮੈਨੂੰ ਲੱਗਿਆ ਕਿ ਉਹ ਜਿਹੜੇ ਏਅਰਪੋਰਟਸ ਹਨ ਉਹ ਖ਼ਰਾਬ ਸਨ ਕਿਉਂਕਿ ਉਹ ਵਿੱਚੋਂ ਹੀ ਟੁੱਟੇ ਹੋਏ ਸਨ ਇਸ ਕਰਕੇ ਇਹ ਮੇਰਾ ਸਭ ਤੋਂ ਬੇਕਾਰ ਐਕਸਪੀਰੀਅੰਸ ਰਿਹਾ ਸੀ ਇੱਕ ਔਨਲਾਈਨ ਸ਼ੋਪਿੰਗ ਪ੍ਰੋਡਕਟ ਦਾ ਧੰਨਵਾਦ